ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਓਕੇ ਜੀ ਓਕੇ ਹਾਂਜੀ ਕਿੱਥੋਂ ਬੋਲ ਰਹੇ ਸੁਖਵਿੰਦਰ ਸਿੰਘ ਜੀ ਓਕੇ ਜੀ ਓਕੇ ਹਾਂਜੀ ਸੁਖਵਿੰਦਰ ਸਿੰਘ ਜੀ ਬੋਲੋ ਜੀ ਹਾਂਜੀ ਹਾਂਜੀ ਓਕੇ ਓਕੇ ਜੀ ਸਭ ਤੋਂ ਪਹਿਲਾਂ ਸੁਖਵਿੰਦਰ ਸਿੰਘ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਜੀ ਓਕੇ ਜੀ ਤੇ ਇਸ ਤੋਂ ਅੱਗੇ ਤੁਸੀਂ ਕੁਛ ਕਰਿਆ ਸੀ ਐੱਮ ਏ ਵਗੈਰਾ ਕਰੀ ਹੈ ਜੀ ਇਸ ਤੋਂ ਪਹਿਲਾਂ ਤੁਸੀਂ ਓਕੇ ਜੀ ਹਾਂਜੀ ਦੇਖੋ ਜ ਬਿਲ ਬਿਲਕੁਲ ਬਿਲਕੁਲ ਸੁਖਵਿੰਦਰ ਸਿੰਘ ਜੀ ਦੇਖਿਓ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਜੀ ਜਿਵੇਂ ਕਿ ਤੁਸੀਂ ਤਾਂ ਮੈਨੂੰ ਦੱਸਿਆ ਤੁਸੀਂ ਨੇ ਬੀ ਏ ਕਰ ਰੱਖੀ ਤੁਸੀਂ ਨੇ ਬੀਐਡ ਕਰ ਰੱਖੀ ਹੈ ਜੀ ਜੇ ਤੁਹਾਡਾ ਜਿਹੜਾ ਤੁਹਾਡਾ ਇਹ ਪ੍ਰਵੈਸ਼ਨ ਹੈ ਜੀ ਇਹ ਤੁਹਾਡਾ ਟੀਚਿੰਗ ਲੈਨ ਵਾਲਾ ਜੀ ਤੁਸੀਂ ਇਹ ਮੰਨ ਲਓ ਹਾਂਜੀ ਤੁਸੀਂ ਟੀਚਿੰਗ ਦੀ ਕਿੱਥੇ ਮੰਨ ਲਓ ਤਿਆਰੀ ਕਰੀ ਤੁਸੀਂ ਕੋਈ ਪੇਪਰ ਦਿੱਤਾ ਜੀ ਜਿਵੇਂ ਕੀ ਇਹ ਆਪਣਾ ਹੁੰਦਾ ਪੰਜਾਬ ਦਾ ਪੀ ਐੱਫ ਸੈਟ ਹੁੰਦਾ ਜੀ ਜਿਵੇਂ ਸੈਂਟਰ ਦੇ ਪੇਪਰ ਹੁੰਦੇ ਹੈ ਤੁਸੀਂ ਕੋਈ ਪੇਪਰ ਕੁਆਲੀਫਾਈ ਕਰਿਆ ਜੀ ਓਕੇ ਓਕੇ ਓਕੇ ਓਕੇ ਜੀ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਅਗਰ ਤੁਹਾਡਾ ਜਿਹੜਾ ਹੈਂਗਾ ਹੁੰਦਾ ਆਪਣਾ ਪੰਜਾਬ ਦਾ ਜੀ ਪੀ ਐੱਫ ਸੈਟ ਹੁੰਦਾ ਜੀ ਤੁਹਾਡਾ ਉਹ ਕਲੀਅਰ ਕਲੀਅਰ ਹੈਗਾ ਤੁਹਾਡਾ ਜੀ ਉਹ ਕੁਆਲੀਫਾਈ ਹੈਗਾ ਜੀ ਪੇਪਰ ਦੇਣਾ ਜੀ ਓਕੇ ਓਕੇ ਜੀ ਦੇਖੋ ਜੀ ਮੈਂ ਇੱਥੇ ਚੈੱਕ ਕਰ ਲੈਂਦਾ ਮੇਰੇ ਕੋਲ ਕੰਪੂਟਰ ਇੱਥੇ ਹੈਗਾ ਜੀ ਮੈਂ ਤੁਹਾਡੀ ਜੋ ਹੈਗਾ ਹੈ ਉਹ ਤੁਹਾਡੀ ਨੇੜੇ ਦੀ ਲੋਕੇਸ਼ਨ ਮੈਂ ਚੈੱਕ ਕਰ ਰਿਹਾ ਜੀ ਤੁਹਾਨੂੰ ਇੱਥੇ ਜੋ ਹੈਗੀ ਹੈ ਤੁਹਾਨੂੰ ਜੋਬ ਓਪਰਚੁਨਿਟੀ ਤੁਹਾਨੂੰ ਮਿਲ ਸਕਦੀ ਹੈ ਜਿਵੇਂ ਕਿ ਓਕੇ ਓਕੇ ਓਕੇ ਬਿਲਕੁਲ ਜੀ ਦੇਖੋ ਮੈਂ ਚੈੱਕ ਕਰ ਰਿਹਾ ਜੀ ਮੈਂ ਸੁਖਵਿੰਦਰ ਸਿੰਘ ਜੀ ਮੈਂ ਤੁਹਾਡੇ ਨੀਅਰ ਜੋ ਹੈਗੇ ਆਪਣੇ ਇੱਥੇ ਕੋਲ ਸ ਆਪਣੇ ਤੁਹਾਡੇ ਨੀਅਰ ਜੀ ਇੱਥੇ ਮਾਖਾਂ ਚਹਿਲਾਂ ਇੱਥੇ ਹੈ ਤੁਹਾਡੇ ਮਾਖਾਂ ਚਹਿਲਾਂ ਤਾਂ ਇੱਥੇ ਇੱਕ ਸਕੂਲ ਆ ਜੀ ਇੱਥੇ ਪ੍ਰਾਈਵੇਟ ਕੋਈ ਇੱਥੇ ਤੁਹਾਨੂੰ ਇੱਕ ਵੈਕੈਂਸੀ ਇੱਥੇ ਤੁਹਾਨੂੰ ਐਜ਼ ਆ ਪ੍ਰਾਈਵੇਟ ਟੀਚਰ ਤੁਹਾਨੂੰ ਇੱਥੇ ਵੈਕੈਂਸੀ ਇੱਕ ਮਿਲ ਸਕਦੀ ਇੱਥੇ ਵੈਕੈਂਸੀ ਇੱਕ ਮੇਲ ਦੀ ਵੈਕੈਂਸੀ ਇੱਥੇ ਇੱਕ ਖਾਲੀ ਪਈ ਹੈ ਜੀ ਤੁਸੀਂ ਉੱਥੇ ਜਾ ਕੇ ਆਪਦਾ ਰਜ਼ਿਊਮ ਦੇ ਸਕਦੇ ਹੋ ਜੀ ਜਿੰਨਾ ਅੱ ਤੱਕ ਮੰਨ ਲਓ ਤੁਹਾਡਾ ਕੋਈ ਐਜ਼ ਆ ਤੁਹਾਡਾ ਪੇਪਰ ਜਿਹੜਾ ਹੈਗਾ ਤੁਹਾਡਾ ਕੋਈ ਕੁਆਲੀਫਾਈ ਨਹੀਂ ਹੁੰਦਾ ਤੁਸੀਂ ਉੱਥੇ ਐਜ਼ ਆ ਪ੍ਰਾਈਵੇਟ ਟੀਚਰ ਉੱਥੇ ਜੋਬ ਕਰ ਸਕਦੇ ਹੋ ਜੀ ਤੁਸੀਂ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਤੁਸੀਂ ਕਿੰਨੀ ਕਿ ਮੰਨ ਲਓ ਪੇਜ ਤੁਸੀਂ ਪੇਅ ਲੈਣਾ ਚਾਹੁੰਦੇ ਹੋ ਉੱਥੇ ਜੀ ਲੱਗ ਕੇ ਜੀ ਪੰਦਰਾਂ ਪਲਸ ਜੀ ਓਕੇ ਜੀ ਮੈਂ ਦੇਖੋ ਜੀ ਮੈਂ ਉੱਥੇ ਚੈੱਕ ਕਰ ਰਿਹਾ ਤੁਹਾਡੇ ਉੱਥੇ ਮੈਂ ਜਿੱਦਾਂ ਕਿ ਮੈਂ ਕੰਪੂਟਰ ਦੇ ਚੈੱਕ ਕਰ ਰਿਹਾ ਜੀ ਤੁਹਾਨੂੰ ਉੱਥੇ ਸਟਾਰਟਿੰਗ ਜਿਹੜੀ ਪੇਅ ਹੈਗੀ ਆ ਤੁਹਾਨੂੰ ਉੱਥੇ ਦਸ ਹਜ਼ਾਰ ਪੰਜ ਸੌ ਤੁਹਾਨੂੰ ਸ ਸਟਾਰਟਿੰਗ ਪੇਅ ਉੱਥੇ ਤੁਹਾਨੂੰ ਹੈਗੀ ਆ ਜਿਹੜੀ ਤੁਹਾਨੂੰ ਮਿਲ ਸਕਦੀ ਹੈ ਉੱਥੇ ਜੀ ਹਾਂਜੀ ਤੁਸੀਂ ਜਿੱਦੇ ਜਿੱਦਾਂ ਤੁਹਾਨੂੰ ਉਹ ਤੁਹਾਡਾ ਐਕਸਪੀਰੀਅੰਸ ਹੋਈ ਜਾਊ ਜੀ ਤੁਸੀਂ ਉੱਥੇ ਮੰਨ ਲਓ ਐਜ਼ ਆ ਟੀਚਰ ਤੁਸੀਂ ਉੱਥੇ ਪੜ੍ਹਾਈ ਜਾਓਗੇ ਬੱਚਿਆਂ ਨੂੰ ਜੀ ਤਾਂ ਤੁਹਾਡੀ ਜਿਹੜੀ ਪੇਅ ਤੁਹਾਡੀ ਉਹ 'ਚ ਇਨਕਰੀਜ਼ ਹੋਜੂ ਥੋੜ੍ਹੀ ਤੁਹਾਡੀ ਪੇਅ ਜਿਹੜੀ ਹੈਗੀ ਆ ਜੀ ਹਾਂਜੀ ਤੁਸੀਂ ਤੁਹਾਡੇ ਵਾਸਤੇ ਇਹ ਸੁਨਹਿਰੀ ਮੌਕਾ ਜੀ ਤੁਸੀਂ ਉੱਥੇ ਜਾ ਕੇ ਮਾਖਾਂ ਚਹਿਲਾਂ ਉੱਥੇ ਜਾ ਕੇ ਤੁਸੀਂ ਉੱਥੇ ਐਜ਼ ਆ ਟੀਚਰ ਤੁਸੀਂ ਉੱਥੇ ਆ ਕੇ ਜੁਆਇਨ ਕਰ ਸਕਦੇ ਹੋ ਜੀ ਤੁਸੀਂ ਵਧੀਆ ਤੁਹਾਡੇ ਵਾਸਤੇ ਓਪੋਰਚੁਨਿਟੀ ਹੈ ਜੀ ਇੱਕ ਵਾਰ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਉੱਥੇ ਜਾ ਕੇ ਜਿਹੜਾ ਹੈਗਾ ਹੈ ਤੁਸੀਂ ਉੱਥੇ ਜੁਆਇਨ ਕਰ ਸਕਦੇ ਹੋ ਜੇ ਤੁਹਾਡੇ ਤੁਸੀਂ ਇਸ ਨੂੰ ਪਸੰਦ ਕਰਦੇ ਹੋ ਜੀ

ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਤੁਸੀਂ ਇੱਦਾਂ ਕਰੋ ਮੇਰਾ ਨੰਬਰ ਸੇਵ ਕਰ ਲਓ ਜੀ ਜਦੋਂ ਵੀ ਮੰਨ ਲਓ ਕੋਈ ਤੁਹਾਡੀ ਨੂ ਕੋਈ ਓਪੋਰਚੁਨਿਟੀ ਆਉਂਦੀ ਹੈ ਕੋਈ ਨਿਊ ਪੋਸਟ ਵਗੈਰਾ ਆਉਂਦੀ ਹੈ ਤਾਂ ਤੁਹਾਨੂੰ ਮੈਂ ਇਸ ਨੰਬਰ 'ਤੇ ਕੋਲਿੰਗ ਵਗੈਰਾ ਕਰਦਾਂਗਾ ਜੀ ਓਕ ਹਾਂਜੀ ਤੁਸੀਂ ਉਹ ਮੰਨ ਲਓ ਹਾਂਜੀ ਓਕੇ ਜੀ ਓਕੇ ਥੈਂਕ ਯੂ ਜੀ ਓਕੇ ਜੀ